ਮੈਂ ਇੱਕ ਪਿਛੜੇ ਹੋਏ ਪਰਿਵਾਰ ਨੂੰ ਸੰਬੰਧ ਰੱਖਦੀ ਹਾਂ ਜਿੱਥੇ ਕਿ ਪੜ੍ਹਾਈ ਕੁੜੀਆਂ ਦਾ ਪੜ੍ਹਾਈ ਲਿਖਾਈ ਜਿਹੜੀ ਕਈ ਤਰ੍ਹਾਂ ਦੀ ਵਰਜਿਤ ਸੀਗੀ ਸੋ ਮੈਂ ਆਪਣੀ ਖਾਨਦਾਨ ਵਿੱਚੋਂ ਲਗਭਗ ਪਹਿਲੀ ਕੁੜੀ ਸੀ ਜਿਹਨੇ ਪਲੱਸ ਟੂ ਕੀਤੀ ਹੈ ਸੋ ਇਹ ਮੇਰੀ ਇੱਕ ਵੱਡੀ ਪ੍ਰਾਪਤੀ ਸੀ ਉਹ ਦਿਨ ਮੇਰੇ ਲਈ ਬਹੁਤ ਵੱਡਾ ਖੁਸ਼ੀਆਂ ਦਾ ਦਿਨ ਸੀ ਜਿਸ ਦਿਨ ਮੈਂ ਪਲੱਸ ਟੂ ਕੀਤੀ ਹੈ ਉਸ ਤੋਂ ਬਾਅਦ ਮੈਂ ਏ ਐੱਨ ਐੱਮ ਕੀਤੀ ਹੈ ਅਤੇ ਮੈਂ ਜੋਬ 'ਚ ਆਈ ਸੀਗੀ ਸੋ ਇਹ ਮੇਰੇ ਸਭ ਤੋਂ ਵੱਡੀ ਖੁਸ਼ੀ ਵਾਲਾ ਦਿਨ ਸੀਗੇ